ਵੀਹ ਸਤੰਬਰ ਉੱਨੀ ਸੌ ਸਤਾਸੀ ਚਾਰ ਮਈ ਦੋ ਹਜ਼ਾਰ ਵੀਹ ਪੱਚੀ ਮਈ ਉੱਨੀ ਸੌ ਨੱਬੇ ਅਠਾਰ੍ਹਾਂ ਜੁਲਾਈ ਦੋ ਹਜ਼ਾਰ ਇੱਕੀ ਦੋ ਦਸੰਬਰ ਉੱਨੀ ਸੌ ਸਤਾਨਵੇਂ